ਹਾਂਜੀ ਅਸੀਂ ਆਪਣੀ ਰਸੋਈ ਵਿੱਚ ਵੱਖ ਵੱਖ ਬਰਤਨਾਂ ਦਾ ਵਰਣਨ ਕਰ ਸਕਦੇ ਹਾਂ ਜਿਵੇਂ ਬਾਟੀ ਚਮਚ ਥਾਲੀ ਕੜਛੀ ਕੁੱਕਰ ਲੂਣਦਾਨੀ ਦੁੱਧ ਵਾਲੀ ਕੈਨੀ ਟੋਕਰੀ ਚਾਹ ਵਾਲੀ ਕੇਤਲੀ ਆਟਾ ਛਾਨਣੀ ਰੋਟੀ ਵਾਲਾ ਡੱਬਾ ਨਿੰਬੂ ਨਿਚੋੜ ਗਿਲਾਸ ਚਾਕੂ ਵੇਲਣਾ ਤਵਾ ਕੱਦੂਕਸ ਜੱਗ ਕੜਾਹੀ ਦੁੱਧ ਵਾਲੀ ਛਾਨਣੀ ਆਦਿ ਕੁੱਕਰ ਦਾ ਪ੍ਰਯੋਗ ਅਸੀਂ ਸਬਜ਼ੀ ਦਾ ਭਾਪ ਵਾਲੀ ਚੀਜ਼ਾਂ ਬਣਾਉਣ ਲਈ ਕਰਦੇ ਹਾਂ ਦੁੱਧ ਵਾਲੀ ਛਾਨਣੀ ਦਾ ਪ੍ਰਯੋਗ ਅਸੀਂ ਦੁੱਧ ਢੱਕਣ ਲਈ ਕਰਦੇ ਹਾਂ ਚਾਕੂ ਨਾਲ ਸਬਜ਼ੀਆਂ ਕੱਟੀ ਜਾਂਦੀ ਹੈ ਨਿੰਬੂ ਨਿਚੋੜ ਨਾਲ ਨਿੰਬੂ ਦਾ ਰਸ ਕੱਢਿਆ ਜਾਂਦਾ ਹੈ ਵੇਲਣੇ ਨਾਲ ਰੋਟੀ ਵੇਲੀ ਜਾਂਦੀ ਹੈ ਅਤੇ ਤਵੇ ਨਾਲ ਰੋਟੀ ਸੇਕੀ ਜਾਂਦੀ ਹੈ ਜੱਗ ਵਿੱਚ ਪਾਣੀ ਦੁੱਧ ਆਦਿ ਰੱਖਿਆ ਜਾਂਦਾ ਹੈ ਕੜਾਹੀ ਵਿੱਚ ਸਬਜ਼ੀ ਕੜਾਹ ਆਦਿ ਬਣਾਇਆ ਜਾਂਦਾ ਹੈ ਗਿਲਾਸ ਵਿੱਚ ਦੁੱਧ ਪਾਣੀ ਸ਼ਿਕੰਜਵੀ ਆਦਿ ਪਿਲਾਈ ਜਾਂਦੀ ਹੈ